ਮੇਰੇ ਸਕੂਲ ਵਿੱਚ ਲਾਇਬ੍ਰੇਰੀ ਹੈ ਬਚਪਨ ਵਿੱਚ ਮੈਂ ਉਸ ਲਾਇਬ੍ਰੇਰੀ ਵਿੱਚ ਬਹੁਤ ਸਾਰੀਆਂ ਕਿਤਾਬਾਂ ਪੜ੍ਹਦੀ ਸੀ ਇਹਨਾਂ ਦੇ ਵਿੱਚੋਂ ਮੇਰਾ ਦਾਗੀਸਤਾਨ ਪਰਬ ਤੋਂ ਭਾਰੀ ਮੌਤ ਪੰਜਵਾਂ ਸਹਿਬਜਾਦਾ ਚਾਚਾ ਚੌਧਰੀ ਅਤੇ ਗੁਗਲੀ ਇਹ ਮੈਂ ਸਾਰੇ ਹੀ ਪੜ੍ਹੇ ਹੋਏ ਹਨ ਇਸ ਤੋਂ ਸਿਵਾ ਵੀ ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹਦੀ ਹੁੰਦੀ ਸੀ